ਹੈਲੋ ਹੈਲੋ ਆਸ਼ੀਰਵਾਦ ਹੋਸਪਿਟਲ ਤੋਂ ਬੋਲ ਰਹੇ ਹੋ ਜੀ ਹਾਂਜੀ ਡਾਕਟਰ ਸਾਹਿਬ ਜੀ ਅਸੀਂ ਅਬੋਹਰ ਤੋਂ ਬੋਲ ਰਹੇ ਸੀ ਜੀ ਜੀ ਇੱਕ ਮੇਰਾ ਫਰੈਂਡ ਸੀਗਾ ਜੀ ਅਤੇ ਉਹ ਬਹੁਤ ਜ਼ਿਆਦਾ ਨਸ਼ੇ ਕਰਦਾ ਹੈਗਾ ਜੀ ਹਾਂਜੀ ਅਤੇ ਉਹਦੇ ਬਾਰੇ ਅਸੀਂ ਮੈਡੀਸਨ ਵਗੈਰਾ ਦਵਾਈ ਵਗੈਰਾ ਲੈਣੀ ਸੀ ਜੀ ਆਪਣੇ ਹੋਸਪੀਟਲ ਹਾਂਜੀ ਕਿਉਂਕਿ ਉਹ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਨਸ਼ੇ ਕਰ ਰਿਹਾ ਜੀ ਉਹ ਨਸ਼ਾ ਜੀ ਸਿਰਗਟ ਵਗੈਰਾ ਪੀਂਦੇ ਸੀ ਪਹਿਲਾਂ ਤਾਂ ਉਸ ਤੋਂ ਹੁਣ ਉਸ ਤੋਂ ਇਲਾਵਾ ਹੋਰ ਦਿਨੋ ਦਿਨ ਵਧਦੇ ਜਾ ਰਹੇ ਉਹ ਦਾਰੂ ਵਗੈਰਾ ਵੀ ਪੀ ਰਹੇ ਆ ਜੀ ਬਹੁਤ ਜ਼ਿਆਦਾ ਪੀ ਰਹੇ ਆ ਉਹਨਾਂ ਨੂੰ ਪਤਾ ਹੀ ਨਹੀਂ ਚਲਦਾ ਕੁਛ

ਜੀ ਜੀ ਜੀ ਜੀ ਜੀ ਹਾਂਜੀ ਨਹੀਂ ਜੀ ਡਾਕਟਰ ਸਾਹਿਬ ਜੀ ਪ੍ਰੇਰਿਤ ਤਾਂ ਕਰਦੇ ਹਾਂ ਬਹੁਤ ਜ਼ਿਆਦਾ ਉਹਨਾਂ ਨੂੰ ਪਰ ਉਹ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹੈ ਜੀ ਸਾਨੂੰ ਪਤਾ ਲੱਗਿਆ ਸੀਗਾ ਜੀ ਸਾਡੇ ਆਪਣੇ ਕੋਈ ਰਿਲੇਟਿਵ ਹੀ ਸੀ ਉਹਨਾਂ ਨੇ ਲਿਆ ਸੀ ਇੱਥੋਂ ਦਵਾਈ ਜੀ ਅਤੇ ਉਹਨਾਂ ਨੇ ਸਾਨੂੰ ਤੁਹਾਡਾ ਨੰਬਰ ਦਿੱਤਾ ਸੀ ਇਸ ਲਈ ਮੈਂ ਡਾਕਟਰ ਸਾਹਿਬ ਕਾਲ ਕੀਤੀ ਸੀ ਤੁਹਾਨੂੰ ਆਪਣੀ ਟਾਈਮਿੰਗ ਵਗੈਰਾ ਕਦੋਂ ਹੁੰਦੀ ਹੈ ਸਰ ਠੀਕ ਠੀਕ ਹੈ ਸਰ ਠੀਕ ਹੈ ਕੋਈ ਗੱਲ ਨਹੀਂ ਸਰ ਜ਼ਰੂਰ ਆਵਾਂਗੇ ਠੀਕ ਹੈ ਜੀ ਥੈਂਕਯੂ ਜੀ